ਹਾਂਜੀ ਹਾਂਜੀ ਮੈਮ ਠੀਕ ਹੈ ਬੜੀਆ ਹਾਂਜੀ ਹਾਂਜੀ ਮੈਮ ਪਛਾਣ ਲਿਆ ਮੈਮ ਠੀਕ ਹੈੈੈੈੈੈ ਬੜੀਆ ਬੱਚਿਆਂ ਦੀ ਪੜ੍ਹਾਈ ਪੂਰੀ ਆ ਮੈਮ ਠੀਕ ਹੈ ਦੋ ਚ ਇੱਕ ਦੋ ਨੂੰ ਛੱਡ ਕੇ ਉਹ ਤੁਹਾਨੂੰ ਪਤਾ ਕਲਾਸ 'ਚ ਘਰੋਂ ਹੀ ਨਹੀਂ ਪੜ੍ਹ ਕੇ ਆਉਂਦੇ ਨਹੀਂ ਮੈਡਮ ਅੱਜ ਮੈਂ ਗਰੁੱਪ ਬਣਾ ਲਏ ਸੀ ਲੈਵਲ ਵਨ ਅਤੇ ਲੈਵਲ ਟੂ ਦੇ ਲੈਵਲ ਥਰੀ ਦੇ ਅਤੇ ਬੱਚੇ ਕੱਢ ਲਏ ਉਹਨਾਂ 'ਚੋਂ ਹੁਣ ਮੈਂ ਅਸੀਂ ਵੰਡ ਕਰ ਲਈ ਹੈ ਅਤੇ ਵਧੀਆ ਚੱਲ ਰਿਹਾ ਠੀਕ ਹੈ ਜੀ ਮੈਮ ਇੱਕ ਫੈਨ ਖਰਾਬ ਸੀਗਾ ਅਤੇ ਉਹਨੂੰ ਰਿਪੇਅਰ ਕਰਵਾਉਣਾ ਸੀ ਅਤੇ ਉਹ ਕਰਵਾ ਦਿਓ ਅਤੇ ਬੱਚਿਆਂ ਨੂੰ ਗਰਮੀ ਵਗੈਰਾ ਤੋਂ ਰਾਹਤ ਮਿਲ ਜਾਵੇਗੀ ਜਿੱਦਾਂ ਹੁਣ ਗਰਮੀਆਂ ਦੇ ਦਿਨ ਆ ਰਹੇ ਹਾਂਜੀ ਹਾਂਜੀ ਇੱਕ ਸਮਾਰਟ ਬੋਰਡ ਮੈਡਮ ਥੋੜ੍ਹਾ ਜਿਹਾ ਇਹਦੇ 'ਚ ਵੀ ਪ੍ਰੋਬਲਮ ਆਉਂਦੀ ਹੈ ਵਿੱਚ ਵਿੱਚ ਅਤੇ ਇਹਦਾ ਰਿਮੋਟ ਸ਼ਾਇਦ ਖਰਾਬ ਹੈ ਅਤੇ ਉਹ ਵੀ ਉਹਨਾਂ ਨੂੰ ਮੈਂ ਕਿਹਾ ਸੀ ਅਤੇ ਤੁਸੀਂ ਵੀ ਇੱਕ ਵਾਰੀ ਕਹਿ ਦੇਣਾ ਠੀਕ ਹੈ ਜੀ ਬਸ ਬਾਕੀ ਓਕੇ ਮੈਮ ਠੀਕ ਹੈ ਠੀਕ ਹੈ ਮੈਮ ਹਾਂ ਓਕੇ ਮੈਮ ਠੀਕ ਆ ਥੋੜ੍ਹਾ ਫਰਨੀਚਰ ਠੀਕ ਹੈ ਨਹੀਂ ਜੀ ਬਸ ਥੈਂਕ ਹਾਂਜੀ ਠੀਕ ਹੈ ਮੈਡਮ ਠੀਕ ਹੈ ਮੈਡਮ ਠੀਕ ਹੈ ਮੈਡਮ ਫਿਰ ਮਿਲਦੇ ਹਾਂ ਬਾਏ ਜੀ